ਮੈਂ ਪਟਿਆਲੇ ਜ਼ਿਲ੍ਹੇ ਦੀ ਰਹਿਣ ਵਾਲੀ ਹਾਂ ਅਤੇ ਪਟਿਆਲੇ ਸ਼ਹਿਰ ਵਿੱਚ ਦੇ ਪਿੰਡ ਵਿੱਚ ਕਾਫ਼ੀ ਸਾਰੇ ਕਿਸਾਨ ਨੇ ਜਿਹੜੇ ਕਿ ਖੇਤੀ ਕਰਦੇ ਨੇ ਕਾਫ਼ੀ ਸਾਰੇ ਵਿਅਕਤੀ ਨੇ ਜਿਹੜੇ ਕਿ ਡਾਏਰੀ ਖੋਲ੍ਹੀ ਬੈਠੇ ਹਨ ਪਿੰਡਾਂ ਵਿੱਚ ਅਤੇ ਮੱਝਾਂ ਪਾਲਦੇ ਹਨ ਅਤੇ ਡੇਅਰੀ ਖੋਲ੍ਹ ਲੈਂਦੇ ਹਨ ਅਤੇ ਮੱਝਾਂ ਦਾ ਦੁੱਧ ਅੱਗੇ ਘਰ ਘਰ ਜਾ ਕੇ ਵੇਚਦੇ ਨੇ ਕਾਫ਼ੀ ਸਾਰੇ ਵਿਅਕਤੀ ਤਾਂ ਡੇਅਰੀ ਹੀ ਖੋਲ੍ਹ ਲੈਂਦੇ ਨੇ ਅਤੇ ਡੇਅਰੀ ਨੂੰ ਵਧੀਆ ਢੰਗ ਨਾਲ਼ ਚਲਾਉਣ ਲੱਗ ਜਾਂਦੇ ਨੇ ਜਿਨ੍ਹਾਂ ਕਰਕੇ ਉਹਨਾਂ ਨੂੰ ਕਾਫ਼ੀ ਜ਼ਿਆਦਾ ਲਾਭ ਹੁੰਦਾ ਅਤੇ ਜਿਹੜੇ ਕਿਸਾਨ ਨੇ ਉਹ ਫ਼ਸਲਾਂ ਉਗਾਉਂਦੇ ਨੇ ਅਤੇ ਅੱਗੇ ਜਾ ਕੇ ਮੰਡੀਆਂ 'ਚ ਵੇਚਦੇ ਨੇ ਅਤੇ ਅੱਜ ਕੱਲ੍ਹ ਵਿੱਚ ਸਿੰਚਾਈ ਦਾ ਵੀ ਬਹੁਤ ਜ਼ਿਆਦਾ ਤਬਦੀਲੀ ਆਈ ਹੈ ਪਹਿਲਾਂ ਲੋਕ ਖੂਹਾਂ ਰਾਹੀਂ ਖੇਤਾਂ ਨੂੰ ਸਿੰਚਾਈ ਕਰਦੇ ਸੀਗੇ ਅਤੇ ਹੁਣ ਟਿਊਬਜ਼ ਨਾਲ਼ ਕਰਦੇ ਨੇ ਅਤੇ ਫੁਹਾਰਾ ਪ੍ਰਣਾਲੀ ਵੀ ਪ੍ਰਚਲਿਤ ਹੈ ਇਸ ਨਾਲ਼ ਜਿਹੜੀ ਕਿ ਫੁਹਾਰਾ ਪ੍ਰਣਾਲੀ ਨਾਲ਼ ਸਾਡੇ ਪਾਣੀ ਦੀ ਵੀ ਬੱਚਤ ਹੁੰਦੀ ਹੈ ਪਾਣੀ ਜ਼ਿਆਦਾ ਵੇਸਟ ਨਹੀਂ ਹੁੰਦਾ ਅਤੇ ਬਹੁਤ ਹੀ ਵਧੀਆ ਪ੍ਰਣਾਲੀ ਹੈ ਅਤੇ ਜਿਹੜੇ ਕਈ ਜਾਣੇ ਪੋਲਟਰੀ ਫਾਰਮ ਵੀ ਖੋਲ੍ਹ ਲੈਂਦੇ ਨੇ ਪਿੰਡਾਂ ਵਿੱਚ ਅਤੇ ਮੁਰਗੀਆਂ ਨੂੰ ਪਾਲ ਲੈਂਦੇ ਨੇ ਅਤੇ ਮੁਰਗੀਆਂ ਦੇ ਅੰਡਿਆਂ ਨੂੰ ਅੱਗੇ ਜਾ ਕੇ ਬਜ਼ਾਰ ਵਿੱਚ ਵਧੀਆ ਦਾਮ 'ਤੇ ਵੇਚਦੇ ਨੇ ਜਿਨ੍ਹਾਂ ਨਾਲ਼ ਉਹਨਾਂ ਨੂੰ ਬਹੁਤ ਹੀ ਜ਼ਿਆਦਾ ਕਮਾਈ ਵਿੱਚ ਲਾਭ ਹੁੰਦਾ ਅਤੇ ਇਹ ਚੀਜ਼ ਬਹੁਤ ਹੀ ਵਧੀਆ ਉਹਨਾਂ ਨੂੰ ਲਾਭ ਦਿੰਦੀ ਹੈ